ਟਰੈਕਟਰਾਂ ਦੀਆਂ ਕਿਸਮਾਂ ਅਰਜਨ ਫੋਡ ਫਾਰਮ ਟਰੈਕ ਸਵਰਾਜ ਸੋਨਾਲੀਕਾ ਆਦਿ ਕਿਸਮਾਂ ਹਨ ਇਹਨਾਂ ਦੀ ਵਰਤੋਂ ਜ਼ਮੀਨ ਨੂੰ ਵਾਹੁਣ ਲਈ ਕਿਸਾਨਾਂ ਦੁਆ ਦੁਆਰਾ ਕੀਤੀ ਜਾਂਦੀ ਹੈ ਇਹਨਾਂ ਨਾਲ ਕੰਮ ਬਹੁਤ ਹੀ ਘੱਟ ਸਮੇਂ ਵਿੱਚ ਆਸਾਨੀ ਨਾਲ ਹੋ ਜਾਂਦਾ ਹੈ ਰਵਾਇਤੀ ਢੰਗ ਨਾਲ ਬਲਦਾਂ ਅਤੇ ਹਲਾਂ ਨਾਲ ਹੱਥੀਂ ਕੰਮ ਕਰਨਾ ਸੀ ਪਰ ਅੱਜ ਦੇ ਮਸ਼ੀਨੀ ਯੁੱਗ ਵਿੱਚ ਟਰੈਕਟਰਾਂ ਦਾ ਉਤਪਾਦ ਬਹੁਤ ਵੱਧ ਗਿਆ ਹੈ